ਹਾਂਜੀ ਕੁਝ ਮੁਸ਼ਕਲ ਪਕਵਾਨ ਹੈਗੇ ਆ ਜਿਸ ਤਰ੍ਹਾਂ ਵਿਦੇਸ਼ੀ ਪਕਵਾਨ ਨੇ ਜਿਵੇਂ ਇਡਲੀ ਚਾਪਾਂ ਡਰੈਗਨ ਫੂਡ ਆਦਿ ਵਗੈਰਾ ਵਗੈਰਾ ਪ ਪਕਵਾਨ ਜਿਹੜੇ ਬਹੁਤ ਮੁਸ਼ਕਲ ਨੇ ਮੈਂ ਇਹਨਾਂ ਨੂੰ ਪਕਾਉਣਾ ਤਾਂ ਚਾਹੁੰਦੀ ਹਾਂ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਘਰ ਦੇ ਵਿੱਚ ਪਰ ਨਹੀਂ ਬਣਦੇ ਉਹੋ ਜਿਹੇ ਜਿੱਦਾਂ ਮਤਲਬ ਕਿ ਇਸ ਲਈ ਨਹੀਂ ਬਣਦੇ ਕਿਉਂਕਿ ਇ ਇਹਨਾਂ ਦੇ ਵਿੱਚ ਨਾ ਬਾਹਰਲੀ ਸਮੱਗਰੀ ਜਿਹੜੀ ਇਹਦੇ ਵਿੱਚ ਜਿਹੜਾ ਜੋ ਵੀ ਸਮਾਨ ਮਸਾਲੇ ਵਗੈਰਾ ਪੈਂਦੇ ਨੇ ਉਹ ਸਾਡੇ ਪਿੰਡਾਂ ਦੇ ਵਿੱਚ ਉਪਲਬਧ ਨਹੀਂ ਆ ਸਾਡੇ ਪਿੰਡ ਜਿਹੜੇ ਸ਼ਹਿਰ ਬਹੁਤ ਦੂਰ ਹੈ ਸ਼ਹਿਰ ਵਿੱਚ ਸਾਰਾ ਕੁਛ ਉਪਲਬਧ ਹੁੰਦਾ ਹੈ ਪਿੰਡਾਂ ਦੇ ਵਿੱਚ ਉਪਲਬਧ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਜੋ ਚੀਜ਼ ਹੁੰਦੀ ਹੈ ਉਹ ਚੀਜ਼ ਨੂੰ ਪਾ ਕੇ ਬਣਾਉਣ ਦੀ ਕੋਸ਼ਿਸ਼ ਤਾਂ ਕਰੀ ਦੀ ਹੈ ਪਰ ਜਿਹੜਾ ਪਕਵਾਨ ਹੈ ਉਹ ਉਸ ਟਾਈਪ ਦਾ ਨਹੀਂ ਬਣਦਾ ਜੋ ਸਾਨੂੰ ਬਜ਼ਾਰ ਤੋਂ ਮਿਲਦਾ ਇਸ ਕਰਕੇ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਹਾਂ ਮੈਂ ਇਹਨੂੰ ਬਣਾਉਣਾ ਤਾਂ ਸਿੱਖਣਾ ਚਾਹੁੰਦੀ ਹਾਂ ਪਰ ਸਿਰਫ ਚੀਜ਼ ਹੈ ਇਹਨਾਂ ਸਮੱਗਰੀ ਦੀ ਘਾਟ ਦੁਰਲਭਤਾ ਜੋ ਕਿ ਸਾਡੇ ਪਿੰਡ ਵਿੱਚ ਉਪਲਬਧ ਨਹੀਂ ਹੈ ਉਪਲਬਧ ਨਹੀਂ ਹੈ ਜਿਵੇਂ ਓਵਨ ਹੋ ਗਿਆ ਇਡਲੀ ਬਣਾਉਣ ਵਾਲੇ ਸਾਂਚੇ ਹੋ ਗਏ ਜਿਨ੍ਹਾਂ ਦੇ ਵਿੱਚ ਭੋਜਨ ਪਕਾਇਆ ਜਾਂਦਾ ਹੈ ਬੇਕ ਕੀਤਾ ਜਾਂਦਾ ਉਹ ਵੀ ਸਾਡੇ ਕੋਲ ਮੌਜੂਦ ਨਹੀਂ ਹੈ ਸਾਡੇ ਤੋਂ ਉਪਲਬਧ ਨਹੀਂ ਹੈ ਪਿੰਡਾਂ ਵਿੱਚ ਇਸ ਕਰਕੇ ਇਹਨਾਂ ਪਕਵਾਨਾਂ ਨੂੰ ਬਣਾਉਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਇਹ ਮੁਸ਼ਕਲ ਲੱਗਦੇ ਆ